ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਾਰ ਡੀਲਰ ਬੋਲਦਾਂ ਜੀ ਵਰਿੰਦਰ ਸਿੰਘ ਕਾਰ ਡੀਲਰ ਹੈਲੋ ਕਿਹੜੀ ਕਿਹੜੀ ਚਾਹੀਦੀ ਹੈ ਜੀ ਦੱਸੋ ਦਿੱਲੀ ਨੰਬਰ ਮਿਲ ਜੂਗੀ ਦੱਸੋ ਡੀ ਐੱਲ ਜੀਰੋ ਵਨ ਜੀਰੋ ਵਨ ਸੀ ਏ ਬੱਤੀ ਪੱਚੀ ਖੜ੍ਹੀ ਹੈ ਜੀ ਆਪਣੇ ਪਾ ਫੋਰਚੂਨਰ ਵੀ ਹੈਗੀ ਹੈ ਅਤੇ ਐਨਡੈਵਰ ਵੀ ਹੈ ਦੱਸੋ ਤੁਹਾਨੂੰ ਕਿਹੜੀ ਚਾਹੀਦੀ ਏ ਜੀ ਫਾਰਚੂਨਰ ਦੇ ਗੱਡੀ ਹੈਗੀ ਜੀ ਆਪਣੇ ਪਾ ਦੋ ਹਜ਼ਾਰ ਸਤਾਰ੍ਹਾਂ ਮਾਡਲ ਹੈ ਜੀ ਉਹ ਤੁਹਾਨੂੰ ਬਣ ਜੂਗੀ ਪੰਜ ਸੱਤ ਲੱਖ ਰੁਪਈਏ ਮ ਦੇਖੋ ਜੀ ਹੈਲੋ ਹਾਂਜੀ ਹਾਂਜੀ ਪ੍ਰਾਈਜ਼ ਹੈਗੇ ਜੀ ਸੱਤ ਲੱਖ ਦੀ ਬਣੂਗੀ ਜੀ ਸੱਤ ਲੱਖ ਦੇ ਵਿੱਚ ਵਿੱਚ ਹੈਲੋ ਟੈਰ ਕੰਡੀਸ਼ਨ ਹੈਗੀ ਜੀ ਸੱਤਰ ਪ੍ਰਸੈਂਟ ਅਤੇ ਸਟੱਪਣੀ ਨਾਲ ਹੈ ਜੀ ਅਤੇ ਆਪਣੇ ਇਹਦੇ ਵਿੱਚ ਫਿਊਚਰ ਬਹੁਤ ਵਧੀਆ ਜੀ ਏ ਸੀ ਐਨ ਵਧੀਆ ਕੂਲੈਂਟ ਕੂਲ ਦਿੰਦਾ ਜੀ ਐਨ ਕੂਲਿੰਗ ਐਨ ਵਧੀਆ ਜੀ ਏ ਸੀ ਦੀ ਸਰਵਿਸ ਵਗੈਰਾ ਤੁਹਾਨੂੰ ਕਰਾ ਕੇ ਦੇਵਾਂਗੇ ਜੀ ਓਕੇ ਆਰ ਸੀ ਓਕੇ ਜੀ ਨੰਬਰ ਐਨ ਐੱਨ ਓ ਸੀ ਕਢਾ ਕੇ ਦੇਵਾਂਗੇ ਕਿੱਥੇ ਤੁਸੀਂ ਕਿੱਥੇ ਲੈ ਕੇ ਜਾਣੀ ਜੀ ਵੈਸੇ ਹੈਲੋ ਠੀਕ ਹੈ ਜੀ ਕੋਈ ਨਹੀਂ ਗੱਡੀ ਤੁਹਾਨੂੰ ਵਧੀਆ ਕੰਡੀਸ਼ਨ ਦੀ ਮਿਲੂਗੀ ਐਨ ਜਿਹੋ ਜਿਹੀ ਤੁਸੀਂ ਕਹੋਗੇ ਜੀ ਹੋਰ ਦੇਖ ਲਉ ਹੈਲੋ ਗੱਡੀਆਂ ਆਪਣੇ ਪਾ ਗੱਡੀਆਂ ਤਾਂ ਇਸ ਟਾਇਮ ਆਪਣੇ ਦੂਸਰੀ ਵੀ ਖੜ੍ਹੀ ਜੀ ਥਾਰ ਵੀ ਖੜ੍ਹੀ ਹੈ ਜੀ ਅਤੇ ਜੀਪ ਵੀ ਖੜ੍ਹੀ ਹੈ ਜੀ ਆਲਟੋ ਵੀ ਮਤਲਬ ਹਰੇਕ ਤਰ੍ਹਾਂ ਦੀ ਗੱਡੀ ਇਹ ਫਾਈਨਲ ਤੁਹਾਨੂੰ ਕਰਾ ਦੂੰਗੇ ਜੀ ਦੱਸੋ ਤੁਸੀਂ ਇਹ ਤਾਂ ਡਿਮਾਂਡ ਸੱਤ ਲੱਖ ਦੀ ਹੈ ਜੀ ਹੈਂਜੀ ਹੈਲੋ ਐਡਰੈੱਸ ਦਿੱਲੀ ਦਾ ਹੈ ਜੀ ਬਾਂਦਰਾ ਉਹਦਾ ਆਪਣੇ ਮਹਿਰੋਲੀ ਦਾ ਜੀ ਗੱਡੀ ਦਾ ਹਾਂਜੀ ਠੀਕ ਹੈ ਜੀ ਓਕੇ ਜਦੋਂ ਮਰਜ਼ੀ ਆਓ ਤੁਹਾਡੇ ਵਾਸਤੇ ਖੁੱਲ੍ਹੇ ਜੀ ਦਰਵਾਜ਼ੇ ਓਕੇ ਜੀ ਧੰਨਵਾਦ ਓਕੇ ਓਕੇ ਜੀ